ਭਾਰਤ ਵਿੱਚ ਆਵਾਜਾਈ ਪ੍ਰਣਾਲੀ ਦੀ ਅਵਸਥਾ ਕਾਫ਼ੀ ਬੁਰੀ ਹੈ ਦਿਨ ਚੜ੍ਹਦੇ ਹੀ ਸੜਕਾਂ ਦੇ ਉੱਤੇ ਜਾਮ ਆਮ ਹੀ ਵੇਖੇ ਜਾ ਸਕਦੇ ਹਨ ਸ਼ਹਿਰਾਂ ਦੇ ਵਿੱਚ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਦੇ ਉੱਤੇ ਜਾਮ ਕਈ ਕਈ ਘੰਟਿਆਂ ਦੇ ਵੀ ਲੱਗਦੇ ਹਨ ਸੜਕਾਂ ਦੇ ਉੱਤੇ ਅ ਸਿਗਨਲ ਲਾਈਟਾਂ ਕਈ ਵਾਰ ਠੀਕ ਢੰਗ ਨਾਲ ਕੰਮ ਨਹੀਂ ਕਰਦੀਆਂ ਹੁੰਦੀਆਂ ਕਈ ਵਾਰੀ ਸੜਕਾਂ ਦੇ ਉੱਤੇ ਅਵਾਰਾ ਪਸ਼ੂ ਜਿਹੜੇ ਆਮ ਹੀ ਘੁੰਮਦੇ ਵੇਖੇ ਜੇ ਜਾ ਸਕਦੇ ਹਨ ਜੋ ਕਿ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ ਇਸ ਤੋਂ ਇਲਾਵਾ ਕਈ ਵੱਡੇ ਰੋਡ ਠੀਕ ਬਣੇ ਹਨ ਪ੍ਰੰਤੂ ਜੋ ਛੋਟੀਆਂ ਲਿੰਕ ਸੜਕਾਂ ਹਨ ਉਹਨਾਂ ਦੇ ਉੱਤੇ ਮੁਰੰਮਤ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਹ ਅ ਭਾਰਤੀ ਆਵਾਜਾਈ ਪ੍ਰਣਾਲੀ ਵਿੱਚ ਕੋਈ ਸੁਧਾਰ ਕਰਨਾ ਚਾਹੁੰਦੀ ਹੈ ਤਾਂ ਉਹ ਆਪਣੇ ਬਜਟ ਦੇ ਵਿੱਚ ਹਰ ਸਾਲ ਇੱਕ ਵੱਡੀ ਅਮਾਊਂਟ ਭਾਰਤੀ ਆਵਾਜਾਈ ਪ੍ਰਣਾਲੀ ਨੂੰ ਸੁਧਾਰਨ ਦੇ ਲਈ ਜ਼ਰੂਰ ਰੱਖੇ ਅਤੇ ਇਸ ਤਰਫ਼ ਅ ਹੋਰ ਭਰਤੀਆਂ ਕਰੇ ਅਤੇ ਵੱਧ ਤੋਂ ਵੱਧ ਲਿੰਕ ਰੋਡਾਂ ਨੂੰ ਵੱਡੇ ਰੋਡਾਂ ਦੇ ਨਾਲ ਜੋੜੇ ਧੰਨਵਾਦ